ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂਜੀ ਹੋਰ ਕਿੱਦਾਂ ਠੀਕ ਠਾਕ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਰਮਨ ਦੇ ਪੇਰੈਂਟਸ ਬੋਲ ਰਹੇ ਹੋ ਹਾਂਜੀ ਠੀਕ ਆ ਠੀਕ ਆ ਹਾਂਜੀ ਹਾਂ ਹਾਂਜੀ ਮੈਮ ਮੇਰੇ ਬੱਚੇ ਤਾਂ ਮੈਂ ਵੀ ਸਕੂਲ ਚੇਂਜ ਕਰਵਾਉਣ ਦਾ ਹੀ ਇਸ ਵਾਰ ਸੋਚਦੀ ਸੀ ਤੁਸੀਂ ਇਹ ਵੀ ਸਹੀ ਟਾਈਮ 'ਤੇ ਫੋਨ ਕੀਤਾ ਮੈਨੂੰ ਆਪਾਂ ਤਾਂ ਉਹਨਾਂ ਨੇ ਡਿਸਕਸ ਕਰਨਾ ਸੀ ਨਹੀਂ ਫਰੈਂਡ ਦੇ ਉਹਨਾਂ ਦੋਨੋਂ ਆਪਣੇ ਬੱਚੇ ਤਾਂ ਮੈਂ ਕਿਹਾ ਸੀ ਚਲੋ ਮੈਂ ਤੁਹਾਡੇ ਨਾਲ ਗੱਲ ਕਰਕੇ ਥੋੜ੍ਹਾ ਡਿਸਕਸ ਕਰਦੇ ਹਾਂ ਅਤੇ ਚਲੋ ਉਹਨਾਂ ਨੂੰ ਇੱਕੋ ਹੀ ਸਕੂਲ ਪਾ ਦਵਾਂਗੇ ਆਪਾਂ ਅਤੇ ਹਾਂ ਹਾਂਜੀ ਮੈਮ ਵੈਸੇ ਤਾਂ ਕਾਫੀ ਸਕੂਲ ਹੈਗੇ ਆ ਜਿੱਦਾਂ ਇੱਥੇ ਨੇੜੇ ਮੇਰੇ ਘਰ ਦੇ ਨੇੜੇ ਤਾਂ ਹੈਗਾ ਏਪੀਜੇ ਸਕੂਲ ਵੀ ਹੈਗਾ ਆ ਅਤੇ ਇੱਥੇ ਇੱਕ ਸਕੂਲ ਹੈਗਾ ਮੈਮ ਮੈਂ ਸੁਣਿਆ ਅਤੇ ਅੱਛਾ ਅੱਛਾ ਆਹ ਹਾਂਜੀ ਮੈਮ ਹਾਂਜੀ ਮੈਂ ਵੈਸੇ ਮੈਂ ਸੋਚਿਆ ਸੀਗਾ ਮੈਂ ਕਿਹਾ ਚਲੋ ਬੱਚੇ ਥੋੜ੍ਹਾ ਜਿਹਾ ਨਾ ਆਪਣੇ ਜਿੱਦਾਂ ਸਿੱਖੀ ਨਾਲ ਵੀ ਰਿਲੇਟਿਡ ਰਹਿਣ ਤਾਂ ਫਿਰ ਉਹ ਸਕੂਲ ਮੈਂ ਸੋਚਿਆ ਸੀਗਾ ਵੀ ਇੱਥੇ ਇੱਕ ਸੀਗਾ ਹਜਾਰੇ ਇੱਕ ਸਕੂਲ ਗੁਰੂ ਤੇਗ ਬਹਾਦਰ ਅਤੇ ਮੈਂ ਕਿਹਾ ਚਲੋ ਉੱਥੇ ਬੱਚੇ ਥੋੜ੍ਹੇ ਆਪਣੇ ਧਰਮ ਨਾਲ ਜੁੜੇ ਰਹਿੰਦੇ ਆ ਹੈ ਨਾ ਉੱਥੇ ਕਾਫੀ ਰਿਲੀਜਅਸ ਹਾਂਜੀ ਇੰਗਲਿਸ਼ ਮੀਡੀਅਮ ਹਾਂਜੀ ਮੈਮ ਇੱਥੇ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਹੈਗਾ ਤਾਂ ਇੱਥੇ ਵੀ ਹਾਂ ਹਾਂਜੀ ਹਾਂਜੀ ਮੈਮ ਮੈਂ ਸੁਣਿਆ ਹਾਂਜੀ ਮੈਮ ਮੈਂ ਸੁਣਿਆ ਤਾਂ ਹੈਗਾ ਇਹਦੇ ਸਕੂਲ ਦੇ ਬਾਰੇ ਕਿਉਂਕਿ ਸਾਡੇ ਗੁਆਂਢ ਦੇ ਵਿੱਚ ਬੱਚੇ ਕਾਫੀ ਔਖੇ ਜਾਂਦੇ ਤਾਂ ਕਰਕੇ ਮੈਂ ਥੋੜ੍ਹਾ ਜਿਹਾ ਸੀਗਾ ਕਿ ਮੈਂ ਬੱਚੇ ਨੂੰ ਹਾਂ ਹਾਂਜੀ ਮੈਮ ਇੱਥੇ ਜਦੋਂ ਸੀ ਬੀ ਐਸ ਸੀ ਪੈਟਰਨ ਹੀ ਆ ਬੱਚਿਆਂ ਸਕੂਲ ਦਾ ਅਤੇ ਉੱਥੇ ਬੱਚਿਆਂ ਦਾ ਹਾਂਜੀ ਹਾਂ ਹਾਂਜੀ ਹੈਗਾ ਤਾਂ ਸੀ ਬੀ ਐਸ ਸੀ ਪੈਟਰਨ ਹੀ ਆ ਬੱਚੇ ਦੀ ਮਲਕੀ ਸਟੱਡੀ ਵੀ ਬਹੁਤ ਅੱਛੀ ਸਟਾਫ ਵੀ ਅੱਛਾ ਆ ਬੱਚਿਆਂ ਨੂੰ ਕਾਫੀ ਰਿਲੀਜਅਸ ਨਾਲ ਜੋੜ ਕੇ ਰੱਖਦੇ ਆ ਸ਼ਬਦ ਵਗੈਰਾ ਬੱਚਿਆਂ ਨੂੰ ਸਾਰਾ ਸਾਰਾ ਸਿਖਾਉਂਦੇ ਆ ਸਕੂਲ ਦੇ ਵਿੱਚ ਹਾਂਜੀ ਹਾਂਜੀ ਮੈਮ ਨਹੀਂ ਨਹੀਂ ਮੈਮ ਪ੍ਰੋਪਰ ਪੀਰੀਅਡ ਲੱਗਦਾ ਆ ਇੱਥੇ ਸਕੂਲ ਦੇ ਵਿੱਚ ਅਤੇ ਬੱਚਿਆਂ ਨੂੰ ਸਿਖਾਏ ਜਾਂਦੇ ਆ ਸ਼ਬਦ ਹਾਂਜੀ ਇੱਥੇ ਫਿਰ ਹਾਂਜੀ ਹਾਂਜੀ ਚਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਠੀਕ ਆ ਫਿਰ ਜਦੋਂ ਮਿਲਦੇ ਆ ਹਾਂਜੀ ਜਦੋਂ ਮਿਲ ਗਏ ਨਾ ਫਿਰ ਆਪਾਂ ਡਿਸਕਸ ਕਰਦੇ ਹਾਂ ਹਾਂ ਹਾਂਜੀ ਹਾਂਜੀ ਠੀਕ ਆ ਹਾਂਜੀ ਚਲੋ ਠੀਕ ਆ ਓਕੇ ਮੈਮ